ਜਿਹੜੇ ਮੇਰੇ ਖਿਆਲ ਵਿੱਚ ਸ ਮਤਲਬ ਸਰਕਾਰ ਅਤੇ ਹੋਰ ਸੰਸਥਾਵਾਂ ਪੰਜਾਬ ਵਿਚ ਖੇਤੀ ਉਦਯੋਗ ਨੂੰ ਬਹੁਤ ਸਾਰੇ ਢੰਗਾਂ ਨਾਲ ਸਹਾਇਤਾ ਦੇ ਸਕਦੀਆਂ ਹਨ ਇਹਦੇ 'ਚ ਇਹਦੇ ਵਿੱਚ ਜਿਹੜਾ ਸਭ ਤੋਂ ਮੇਨ ਕੰਮ ਆਉਂਦਾ ਹੈਗਾ ਸਭ ਤੋਂ ਜਿਹੜਾ ਬੇਸ ਬੇਸਿਕ ਹੈਗਾ ਹੈ ਉਹ ਹੈਗਾ ਫਸਲਾਂ ਨੂੰ ਜਿੱਦਾਂ ਕੋਈ ਵੀ ਕਿਸਾਨ ਹੈਗਾ ਹੈ ਉਹਨੂੰ ਉਹਨੂੰ ਫ਼ਸਲ ਦਾ ਉਚਿਤ ਮੁੱਲ ਦੇਣਾ ਉਹਦੇ ਵਾਸਤੇ ਇੱਕ ਮਿਨੀਅਮ ਜਿੱਦਾਂ ਐੱਮ ਐੱਸ ਪੀ ਹੈ ਉਹਦੇ ਵਾਸਤੇ ਐੱਮ ਐੱਸ ਪੀ ਹੁੰਦਾ ਮਿਨੀਅਮ ਸੈਲਿੰਗ ਪ੍ਰਾਈਜ਼ ਮਤਲਬ ਸਭ ਤੋਂ ਕ ਮਤਲਬ ਪਹਿਲਾਂ ਕੋਈ ਵੀ ਫ਼ਸਲ ਦਾ ਸਾਨੂੰ ਮਿਨੀਅਮ ਸੈਲਿੰਗ ਪ੍ਰਾਈਜ਼ ਸਾਨੂੰ ਪ੍ਰੋਵਾਈਡ ਕਰਵਾਉਣਾ ਉਹਦੇ ਵਾਸਤੇ ਸਾਨੂੰ ਇੱਕ ਜਿੱਦਾਂ ਮਤਲਬ ਕੋਈ ਵੀ ਫਸਲ ਬੀਜਦੇ ਉਹਦੇ ਸਾਨੂੰ ਪਤਾ ਲੱਗ ਜਾਂਦਾ ਕਿ ਵੀ ਫਸਲ ਸਾਡੀ ਜਿਹੜੀ ਹੈਗੀ ਆ ਉਹ ਇੰਨੇ ਕੁ ਰੇਟ ਤੇ ਚੱਲ ਜਾਣੀ ਹੈਗੀ ਹੈ ਨਹੀਂ ਵਿੱਚ ਦਲਾਲ ਪੈ ਕੇ ਜਿਹੜਾ ਫਸਲਾਂ ਦੇ ਰੇਟ ਹੈ ਉਹ ਉੱਪਰ ਥੱਲਾ ਹੁੰਦੇ ਰਹਿੰਦੇ ਹੈਗੇ ਇਹਦੇ ਨਾਲ ਜਿਹੜਾ ਕਿਸਾਨ ਨੂੰ ਹੈ ਕਾਫ਼ੀ ਘਾਟਾ ਪੈ ਜਾਂਦਾ ਹੈਗਾ ਹੈ ਉਹਤੋਂ ਇਲਾਵਾ ਜਿਹੜੀਆਂ ਜਿਹੜੀਆਂ ਮਤਲਬ ਸਰਕਾਰਾਂ ਏ ਇਹ ਤੇ ਇਲਾਵਾ ਹੋਰ ਕਿਆ ਕੰਮ ਕਰ ਸਕਦੀਆਂ ਇਹ ਤੇ ਇਲਾਵਾ ਜਿਹੜੀਆਂ ਸਰਕਾਰਾਂ ਹੈਗੀਆਂ ਜਿੱਦਾਂ ਹੁਣ ਕੋਈ ਬੰਦਾ ਮੰਨ ਲਓ ਖੇਤੀ ਕਰਦਾ ਹੈਗਾ ਹੈ ਖੇਤੀ ਕਰਨ ਵਾਸਤੇ ਸਰਕਾਰ ਨੂੰ ਜਿਹੜਾ ਕ੍ਰੈਡਿਟ ਲੋਨ ਜਿੱਦਾਂ ਹੁਣ ਆਪਾਂ ਦੇਖਿਆ ਜਾਵੇ ਜਿਹੜਾ ਮੈਡਵਲ ਹਿਸਟੀ ਹੈ ਜਾਂ ਕੁਛ ਵੀ ਹੈਗਾ ਹੈ ਉਹਦੇ ਵਿੱਚ ਸਾਰਾ ਕੁਛ ਜਿਹੜੀਆਂ ਕੋਈ ਵੀ ਜਿਹੜਾ ਭਾ ਭਾਰਤ ਦਾ ਰਾਜਾ ਹੋਇਆ ਹੈਗਾ ਉਹ ਖੇਤੀ ਕਰਨ ਵਾਸਤੇ ਜਿਹੜੇ ਲੋਕਾਂ ਨੂੰ ਹੈਗਾ ਹੈ ਉਹਦਾ ਮੇਨ ਸੋਰਸ ਕਿਆ ਹੁੰਦਾ ਤਾ ਉਹਦਾ ਮੇਨ ਸੋਰਸ ਹੁੰਦਾ ਸੀਗਾ ਐਗਰੀਕਲਚਰ ਐਗਰੀਕਲਚਰ ਜਿਹੜਾ ਜਿਹੜੇ ਕਿਸਾਨ ਹੁੰਦੇ ਸੀਗੇ ਉਹਨਾਂ ਨੂੰ ਉਹ ਕ੍ਰੈਡਿਟ ਲੋਨ ਪ੍ਰੋਵਾਈਡ ਕਰਦਾ ਸੀਗਾ ਸਿਰਫ਼ ਉਹ ਖੇਤੀ ਦੇ ਨਾਂ ਤੇ ਲੋਨ ਦੇ ਦਿੰਦੇ ਸੀਗੇ ਬਾਅਦ 'ਚ ਉਹਦੇ ਤੋਂ ਉਹ ਕਿਸ਼ਤਾਂ ਦੇ ਰੂਪ ਵਿੱਚ ਉਹਦੇ ਤੋਂ ਲੈ ਲਿਆ ਜਾਂਦਾ ਸੀਗਾ ਇਸ ਤਰ੍ਹਾਂ ਜਿਹੜੇ ਪੰਜਾਬ ਸਰਕਾਰ ਹੈ ਉਹਨਾਂ ਨੂੰ ਵੀ ਮਤਲਬ ਖੇਤੀ ਦੇ ਵਿੱਚ ਕ੍ਰੈਡਿਟ ਲੋਨ ਦੀ ਜਿਹੜੀ ਹੈਗੀ ਹੈ ਸੁਵਿਧਾਵਾਂ ਵਗੈਰਾ ਅਤੇ ਇਹ ਤੋਂ ਇਲਾਵਾ ਹੋਰ ਵੀ ਜਿਹੜੇ ਸੰਦ ਵੱਟੇ ਆ ਉਨ੍ਹਾਂ ਦੇ ਅਤੇ ਇਸਤੋਂ ਇਲਾਵਾ ਜਿਹੜੇ ਮਤਲਬ ਮੇਨ ਸਮੱਸਿਆ ਕਿਸਾਨਾਂ ਨੂੰ ਆਉਂਦੀ ਹੈਗੀ ਹੈ ਪਾਣੀ ਦੀ ਅਤੇ ਉਹਨਾਂ ਨੂੰ ਪਾਣੀ ਦੇ ਵੀ ਅਲੱਗ ਅਲੱਗ ਤਰ੍ਹਾਂ ਨਾਲ ਜਿਹੜੇ ਖੇਤਾਂ ਦਾ ਕੰਮ ਮਤਲਬ ਪੁੱਜਦਾ ਕਰਵਾ ਦੇਣਾ ਚਾਹੀਦਾ ਹੈਗਾ ਜਿਹਦੇ ਨਾਲ ਮਤਲਬ ਕਿਸਾਨਾਂ ਨੂੰ ਮਤਲਬ ਹੋਰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਇਹਤੇ ਇਲਾਵਾ ਵੀ ਜਿਹੜੇ ਕਿਸਾਨਾਂ ਨੂੰ ਹੈ ਉਹਨਾਂ ਨੂੰ ਖੇਤੀ ਦੇ ਸਬੰਧਿਤ ਹੋਰ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਨੂੰ ਸਰਕਾਰ ਨੂੰ ਛੇਤੀ ਤੋਂ ਛੇਤੀ ਸੁਲਝਾ ਦੇਣਾ ਚਾਹੀਦਾ ਹੈ